ਮੇਰੇ ਮੰਮੀ ਪਾਪਾ ਨੂੰ ਅੱਜ ਕੱਲ੍ਹ ਸਾਹ ਦੀ ਬੜੀ ਪ੍ਰੋਬਲਮ ਹੋ ਰਹੀ ਹੈ ਪਤਾ ਨਹੀਂ ਤਾਂ ਮੌਸਮ ਚੇਂਜ ਹੋ ਰਿਹਾ ਪਤਾ ਨਹੀਂ ਕੀ ਹੋ ਰਿਹਾ ਮੇਰੇ ਹਸਬੈਂਡ ਵੀ ਘਰ ਹੈ ਨਹੀਂ ਬੱਚੇ ਵੀ ਘਰ ਹੈ ਨਹੀਂ ਕਿਹਨੂੰ ਫੋਨ ਲਗਾਵਾਂ ਦਿਲ ਕਰਦਾ ਕਿਸੀ ਆਸ ਪੜੋਸ ਵਾਲਿਆਂ ਨੂੰ ਪੁੱਛਾ ਦਿਲ ਕਰਦਾ ਗੂਗਲ 'ਚ ਸਰਚ ਮਾਰਾ ਕੀ ਕਰਾਂ ਬਹੁਤ ਜ਼ਿਆਦਾ ਪ੍ਰੋਬਲਮ ਹੋ ਰਹੀ ਹੈ ਬਜ਼ੁਰਗ ਵੀ ਪਰੇਸ਼ਾਨ ਹੋ ਰਹੇ ਨੇ ਘਰ ਦੇ ਵਿੱਚ ਕੋਈ ਹੈ ਵੀ ਨਹੀਂ ਹੈਗਾ ਹੈਲਪ ਕਰਨ ਵਾਲਾ ਮੇਰੇ ਕੋਲ ਗੱਡੀ ਗੁੱਡੀ ਵੀ ਹੈ ਨਹੀਂ ਜਿਹੜੀ ਮੈਂ ਗੱਡੀ 'ਚ ਪਾ ਕੇ ਲੈ ਜਾ ਪਹਿਲਾਂ ਓਨਲਾਈਨ ਕੈਬ ਬੁੱਕ ਕਰਾਂ ਫਿਰ ਮੈਂ ਲੈ ਜਾਵਾਂ ਕਿਸੇ ਡਾਕਟਰ ਕੋਲ ਪਰ ਡਾਕਟਰ ਦੀ ਵੀ ਨੀ ਸਮਝ ਆ ਰਹੀ ਕਿਹੜੇ ਡਾਕਟਰ ਕੋਲ ਜਾਵਾਂ ਮੈਨੂੰ ਪਤਾ ਹੀ ਨਹੀਂ ਡਾਕਟਰਾਂ ਦਾ ਕਿਹੜਾ ਡਾਕਟਰ ਹੈਗਾ ਅਤੇ ਕਿਹੜਾ ਡਾਕਟਰ ਨਹੀਂ ਹੈਗਾ ਕੋਈ ਹੈਲਪ ਨਹੀਂ ਮਿਲਦੀ ਪਈ ਆਸ ਪੜੋਸ ਵਾਲੇ ਵੀ ਇੱਦਾਂ ਹੀ ਨੇ ਨੈਰੋਮਾਈਡਿਡ ਨੇ ਸਾਰੇ ਅਨਪੜ੍ਹ ਨੇ ਸਾਰੇ ਕੁਝ ਸਮਝ ਨਹੀਂ ਆ ਰਿਹਾ ਮੈਂ ਬਹੁਤ ਪਰੇਸ਼ਾਨ ਆ ਪਲੀਜ਼ ਪਲੀਜ਼ ਪਲੀਜ਼